ਸਤਿ ਸ਼੍ਰੀ ਅਕਾਲ ਜੀ ਤੁਸੀਂ ਧਾਰੀਵਾਲ ਟ੍ਰੈਵਲ ਤੋਂ ਗੱਲ ਕਰ ਰਹੇ ਹੋ ਹੋਰ ਸਰ ਕੀ ਹਾਲ ਚਾਲ ਜੀ ਅਸੀਂ ਦਸ ਕੁ ਦਿਨਾਂ ਲਈ ਸਾਨੂੰ ਗੱਡੀ ਕਿਰਾਏ 'ਤੇ ਚਾਹੀਦੀ ਹੈ ਤੁਹਾਡੇ ਕੋਲ਼ ਕਿਹੜੀ ਕਿਹੜੀ ਗੱਡੀ ਹੈ ਟੈਪੂ ਟਰੈਵਲਰ ਦਾ ਕੀ ਕਿਰਾਇਆ ਹੈ ਇਨੋਵਾ ਦਾ ਕੀ ਕਿਰਾਇਆ ਪਵੇਗਾ ਸਕ੍ਰੋਪੀਓ ਦਾ ਕੀ ਕਿਰਾਇਆ ਪਵੇਗਾ ਦਸ ਕੁ ਦਿਨ ਲਈ ਸਾਨੂੰ ਇਹ ਉਧਾਰ ਚਾਹੀਦੀ ਹੈ ਅਸੀਂ ਸ਼ਿਮਲਾ ਕੁੱਲੂ ਮਨਾਲੀ ਮਨੀਕਰਨ ਸਾਹਿਬ ਡਲਹੋਜ਼ੀ ਇੰਨਾ ਸਾਡਾ ਘੁੰਮਣ ਜਾਣਾ ਹੈ ਮੈਂ ਅਤੇ ਮੇਰਾ ਦੋਸਤ ਦੀ ਫੈਮਲੀ ਹੈ ਅੱਠ ਦਸ ਜਾਣੇ ਅਸੀਂ ਹੈ ਅੱਠ ਦਸ ਜਾਣੇ ਹੈ ਜੀ ਤੁਸੀਂ ਸਾਨੂੰ ਆਪਣੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ਼ ਸਾਨੂੰ ਦੱਸ ਦਿਉ ਵੀ ਤੁਹਾਡੀ ਟੈਂਪੂ ਟ੍ਰੈਵਲਰ ਦਾ ਕਿੰਨਾ ਕਿਰਾਇਆ ਸਾਨੂੰ ਪਵੇਗਾ ਅਤੇ ਦਸ ਦਿਨ ਦਾ ਸਾਡਾ ਟੂਰ ਹੈ ਪਹਾੜ੍ਹਾਂ ਪਹਾੜ੍ਹੀ ਇਲਾਕੇ ਵਿੱਚ ਜਾਣਾ ਹੈ ਜਾਣ ਜਾਣਾ ਹੈ ਅਸੀਂ ਤੁਸੀਂ ਸਾਨੂੰ ਆਪਣਾ ਕਿਰਾਇਆ ਪ੍ਰਤੀ ਕਿਲੋਮੀਟਰ ਦਾ ਕਿਰਾਇਆ ਦੱਸ ਦਿਉ ਕੀ ਸਰਵਿਸ ਚਾਰਜ ਹੋਵੇਗੀ ਅਗਰ ਡਰਾਈਵਰ ਨੂੰ ਨਾਲ਼ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਤਾਂ ਉਸਦਾ ਕੀ ਕਿਰਾਇਆ ਕੀ ਰੈਂਟ ਹੋਵੇਗਾ ਉਸਦਾ ਉਸਦਾ ਹੋਟਲ ਦਾ ਰਹਿਣ ਦਾ ਵਿੱਚ ਹੋਵੇਗਾ ਸਾਡੇ ਨਾਲ਼ ਜਾਂ ਉਸ ਤੋਂ ਅਲੱਗ ਉਸਦਾ ਚੱਲਜੂਗਾ ਇਸ ਬਾਰੇ ਤੁਸੀਂ ਸਾਨੂੰ ਪੂਰੀ ਜਾਣਕਾਰੀ ਦੇ ਦਿਉ